ਹਾਂਜੀ ਸਾਡੇ ਆਲੇ ਦੁਆਲੇ ਕਾਫ਼ੀ ਏ ਟੀ ਐੱਮ ਹਨ ਪਹਿਲਾਂ ਤਾਂ ਇਹਨਾਂ ਦਾ ਇਸਤੇਮਾਲ ਕਾਫ਼ੀ ਹੁੰਦਾ ਸੀ ਲੋਕ ਉਹਨਾਂ ਨੂੰ ਜਲਦੀ ਹੀ ਨਕਦੀ ਮਿਲ ਜਾਂਦੀ ਸੀ ਪਰ ਹੁਣ ਤਾਂ ਨੈੱਟ ਬੈਂਕਿੰਗ ਦਾ ਬੋਲਬਾਲਾ ਹੈ ਅਤੇ ਆਪਣੇ ਫੋਨ ਦੇ ਨਾਲ ਹੀ ਕਾਫ਼ੀ ਹੱਦ ਤੱਕ ਭੁਗਤਾਨ ਹੋ ਜਾਂਦੇ ਹਨ ਅਤੇ ਨਕਦੀ ਦੀ ਲੋੜ ਹੀ ਨਹੀਂ ਪੈਂਦੀ ਪਰ ਕਦੇ ਕਦੇ ਛੋਟੀਆਂ ਦੁਕਾਨਾਂ ਰੇੜੀਆਂ 'ਤੇ ਨਕਦੀ ਦੀ ਲੋੜ ਪੈ ਜਾਂਦੀ ਹੈ ਮੈਂ ਵੀ ਸਬਜ਼ੀ ਲੈਣ ਵਕਤ ਨਕਦੀ ਦੀ ਲੋੜ ਮਹਿਸੂਸ ਕਰਦੀ ਹਾਂ ਪਰ ਫਿਰ ਵੀ ਬੈਂਕਿੰਗ ਅਤੇ ਏ ਟੀ ਐੱਮ ਦੀ ਲੋੜ ਫਿਫਟੀ ਫਿਫਟੀ ਹੀ ਹੈ